ਉੱਨੀ ਸੌ ਸੰਤਾਲੀ ਦੀ ਵੰਡ ਨੂੰ ਕੌਣ ਭੁੱਲ ਸਕਦਾ ਉੱਨੀ ਸੌ ਸੰਤਾਲੀ ਦੀ ਵੰਡ ਨੇ ਇੱਕ ਪਰਿਵਾਰ ਨੂੰ ਦੋ ਹਿੱਸੇ ਵਿੱਚ ਵੰਡ ਦਿੱਤਾ ਇੱਕ ਪਰਿਵਾਰ ਚੜ੍ਹਦੇ ਪਾਸੇ ਚਲਾ ਗਿਆ ਅਤੇ ਦੂਜਾ ਪਰਿਵਾਰ ਲਹਿੰਦੇ ਵਾਲੇ ਪਾਸੇ ਚਲਾ ਗਿਆ ਜਿਸ ਨੂੰ ਅੱਜ ਕੱਲ੍ਹ ਲਹਿੰਦਾ ਪੰਜਾਬ ਜਾਂ ਚੜ੍ਹਦਾ ਪੰਜਾਬ ਕਿਹਾ ਜਾਂਦਾ

ਭਰਾ ਨਾਲੋਂ ਭਰਾ ਟੁੱਟ ਗਿਆ ਭੈਣ ਨਾਲੋਂ ਭੈਣ ਵਿਛੜ ਗਈ ਪਿਓ ਨਾਲੋਂ ਪੁੱਤਰ ਵਿਛੜ ਗਿਆ ਲੋਕਾਂ ਨੂੰ ਇਸ ਤਾਂ ਬਹੁਤ ਹੀ ਮਾਰ ਚੱਲਣੀ ਪਈ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਤੇ ਇਸ ਭਾਈਚਾਰੇ 'ਤੇ ਬਹੁਤ ਮਾੜਾ ਅਸਰ ਪਿਆ ਅੱਜ ਵੀ ਕਈ ਪਰਿਵਾਰ ਪਾਕਿਸਤਾਨ ਵਿੱਚ ਰਹਿ ਰਹੇ ਨੇ ਅਤੇ ਕੁਝ ਪਰਿਵਾਰ ਪ ਭਾਰਤ ਵਿੱਚ ਰਹਿ ਰਹੇ ਨੇ ਜੋ ਇਧਰ ਆਉਣ ਲਈ ਤਰਸ ਰਹੇ ਨੇ ਅਤੇ ਇੱਧਰ ਵਾਲੇ ਉੱਧਰ ਜਾਣ ਲਈ ਵੀ ਤਰਸ ਰਹੇ ਨੇ ਕਿਉਂਕਿ ਉਹਨਾਂ ਦਾ ਬਹੁਤ ਪਰਿਵਾਰ ਜਾਂ ਪਰਿਵਾਰ ਦੇ ਮੈਂਬਰ ਇੱਧਰ ਰਹਿ ਗਏ ਅਤੇ ਇਹਨਾਂ ਦੇ ਬਹੁਤ ਪਰਿਵਾਰ ਦੇ ਮੈਂਬਰ ਉੱਧਰ ਰਹਿ ਗਏ ਸੋ ਕਹਿ ਸਕਦਾ ਕਿ ਉੱਨੀ ਸੌ ਸੰਤਾਲੀ ਦੀ ਵੰਡ ਨੇ ਇੱਕ ਪਰਿਵਾਰ ਨੂੰ ਹੀ ਦੋ ਹਿੱਸੇਆਂ 'ਚ ਵੰਡ ਦਿੱਤਾ ਜੋ ਕਦੇ ਵੀ ਪੂਰਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਇਸ ਦਾ ਦੋਸ਼ੀ ਕਿਸੇ ਨੂੰ ਨਹੀਂ ਮੰਨ ਸਕਦੇ ਸਮੇਂ ਦੀ ਬੁੱਕਲ ਵਿੱਚ ਬਹੁਤ ਕੁਝ ਲੁਕਿਆ ਹੁੰਦਾ ਸ਼ਾਇਦ ਇਸ ਦਾ ਜਵਾਬ ਵੀ ਸਮਾਂ ਹੀ ਦੇਵੇ ਧੰਨਵਾਦ